ਹਾਂਜੀ ਚਿੱਤਰਕਾਰੀ ਲੋਕਾਂ ਲਈ ਉਪਚਾਰਕ ਜਾਂ ਲਾਭਕਾਰੀ ਹੋ ਸਕਦੀ ਹੈ ਮੈਂ ਇਸ ਤੋਂ ਬਹੁਤ ਸਾਰੇ ਗੁਣ ਸਿੱਖੇ ਹਨ ਜਿਵੇਂ ਕਿ ਅਨੁਸ਼ਾਸਨ ਰਚਨਾਤਮਕਤਾ ਅਤੇ ਕਲਪਨਾ ਅਨੁਸ਼ਾਸਨ ਵਿੱਚ ਦੇਖਿਆ ਜਾਵੇ ਤਾਂ ਗੁਰਦੁਆਰੇ ਸਾਹਿਬ ਵਿੱਚ ਵੀ ਅਨੁਸ਼ਾਸਨ ਬਾਰੇ ਦੱਸਿਆ ਜਾਂਦਾ ਹੈ ਕਿ ਰੌਲਾ ਜ਼ਿਆਦਾ ਰੌਲਾ ਰੱਪਾ ਨਹੀਂ ਪਾਉਣਾ ਸ਼ਾਂਤਮਈ ਢੰਗ ਨਾਲ ਲੰਗਰ ਛੱਕਣਾ ਹੈ ਅਤੇ ਮੈਂ ਇਸ ਤੋਂ ਰਚਨਾਤਮਕ ਗੁਣ ਰਚਨਾਤਮਕਤਾ ਗੁਣ ਵੀ ਸਿੱਖੇ ਹਨ ਜਿਵੇਂ ਗੁਰਬਾਣੀ ਦੀ ਕੁਝ ਤੁਕਾਂ ਵੀ ਚਿੱਤਰ ਚਿੱਤਰਕਾਰੀ ਵਿੱਚ ਆ ਜਾਂਦੀਆਂ ਹਨ ਅਤੇ ਕਲਪਨਾ ਵਿੱਚ ਅਗਰ ਅਸੀਂ ਕਿਸੇ ਦਾ ਚਿੱਤਰ ਬਣਾਉਣਾ ਹੈ ਕਿਸੀ ਇਨਸਾਨ ਦਾ ਜਾਂ ਕਿਸੀ ਚੀਜ਼ ਦਾ ਵੀ ਤਾਂ ਉਸ ਵਿੱਚ ਸਾਨੂੰ ਆਪਣੇ ਦਿਮਾਗ਼ ਵਿੱਚ ਪਹਿਲਾਂ ਉਸ ਚੀਜ਼ ਦੀ ਕਲਪਨਾ ਕਰਨੀ ਪੈਂਦੀ ਹੈ